ਸਾਡੇ ਇਲਾਕੇ ਵਿੱਚ ਇੱਕ ਡਾਂਸ ਅਕੈਡਮੀ ਹੈ ਜੋ ਕਿ ਬਹੁਤ ਵਧੀਆ ਹੈ ਜਿੱਥੇ ਕਿ ਛੋਟੇ ਛੋਟੇ ਨਿਆਣੇ ਆਉਂਦੇ ਹੈ ਉਹ ਡਾਂਸ ਸਿੱਖਦੇ ਹੈ ਡਾਂਸ ਰਾਹੀਂ ਉਹ ਆਪਣੇ ਆਪ ਨੂੰ ਬਦਲਦੇ ਹੈ ਕਈਆਂ ਨੂੰ ਡਾਂਸ ਕਰਨ 'ਚ ਬਹੁਤ ਸੁੱਖ ਸ਼ਾਂਤੀ ਮਿਲਦੀ ਹੈ ਕਈ ਕਈ ਪੰਜਾਬੀ ਸੱਭ ਸੱਭਿਆਚਾਰ ਨੂੰ ਆਪਣੇ ਡਾਂਸ ਰਾਹੀਂ ਪ੍ਰਗਟ ਕਰਦੇ ਹੈ ਇਸ ਕਰਕੇ ਡਾਂਸ ਅਕੈਡਮੀ ਹੋਣਾ ਸਾਡੇ ਇਲਾਕੇ ਵਿੱਚ ਬਹੁਤ ਜ਼ਰੂਰੀ ਮੁੱਦਾ ਹੈ ਡਾਂਸ ਨਾਲ ਅਸੀਂ ਆਪਣੇ ਭਾਵਾਂ ਨੂੰ ਪ੍ਰਗਟ ਕਰ ਸਕਦੇ ਹਨ ਜਿੱਦਾਂ ਕਿ ਅਪ ਸਾਡੇ ਇਲਾਕੇ ਵਿੱਚ ਡਾਂਸ ਅਕੈਡਮੀ ਹੈ ਉੱਦਾਂ ਉੱਦਾਂ ਜਿੱਦਾਂ ਹੋਰ ਡਾਂਸਰਾਂ ਦੀ ਅਵਸ਼ਕਤਾ ਪੈਂਦੀ ਹੈ ਜਿਹਦੇ ਨਾਲ ਨੌਕਰੀ ਦੀ ਸੰਭਾਵਨਾ ਵੀ ਵੱਧਦੀ ਹੈ ਡਾਂਸ ਅਗਰ ਵਧੀਆ ਹੋਵੇਗਾ ਤਾਂ ਬੱਚਾ ਕਿੱਥੇ ਦਾ ਕਿੱਥੇ ਪੁੱਜ ਜਾਂਦਾ ਹੈ